ਨਵੇਂ ਯੁੱਗ ਦੇ ਕਿਸਾਨ ਹਨ ਉਹਨਾਂ ਦਾ ਜੋ ਕਰਨ ਦਾ ਨਵਾਂ ਲਾਈਫਸਟਾਈਲ ਹੈ ਜਿਸ ਵਿੱਚ ਉਹ ਡੇਰੀ ਫਾਰਮਿੰਗ ਦਾ ਕਰਨਾ ਕੰਮ ਕਰਨਾ ਪਸੰਦ ਕਰਦੇ ਹਨ ਅਤੇ ਇਸ ਤੋਂ ਇਲਾਵਾ ਹੋਰ ਮੱਛੀ ਫਾਰਮਿੰਗ ਦਾ ਕੰਮ ਕਰਕੇ ਮੱਛੀ ਫਾਰਮਿੰਗ ਦਾ ਕੰਮ ਕਰਨ ਦੇ ਨਾਲ ਨਾਲ ਉਹਨਾਂ ਨੂੰ ਸਰਕਾਰ ਵੱਲੋਂ ਹੈ ਜੋ ਸਬਸਿਡੀ ਮਿਲਦੀ ਹੈ ਸਬਸਿਡੀ ਮਿਲਣ ਦੇ ਨਾਲ ਅਤੇ ਅਨਸ਼ੋਰੰਸ਼ ਵੀ ਹੋ ਜਾਂਦੀ ਹੈ ਉਸ ਤੋਂ ਬਾਅਦ ਡੇਅਰੀ ਫਾਰਮਿੰਗ ਦੇ ਵਿੱਚ ਗਾਵਾਂ ਦਾ ਕੰਮ ਹੈ ਜੋ ਬੜਾ ਲਾਭਦਾਇਕ ਕੰਮ ਹੈ ਇ ਜਿਸਨੂੰ ਕਿਸਾਨ ਬੜੇ ਵਧੀਆ ਤਰੀਕੇ ਨਾਲ ਕਰ ਸਕਦੇ ਹਨ ਅਤੇ ਇਸ ਤੋਂ ਇਲਾਵਾ ਨਵੇਂ ਜੋ ਕਿਸਾਨ ਹਨ ਉਹ ਵਧੀਆ ਤਰੀਕੇ ਨਾਲ ਵਧੀਆ ਯੂਨੀਵਰਸਿਟੀਆਂ ਦੇ ਨਾਲ ਲਿੰਕ ਹੋ ਕੇ ਵਧੀਆ ਯੂਨੀਵਰਸਿਟੀਆਂ ਤੋਂ ਬੀ ਲੈ ਕੇ ਜਿਸਨੂੰ ਜਿਸਦੀ ਵਧੀਆ ਕਿਸਮਾਂ ਉਹ ਖੇਤਾਂ ਦੇ ਵਿੱਚ ਉਗਾਉਂਦੇ ਹਨ ਅਤੇ ਅੱਗੇ ਤੋਂ ਵਧੀਆ ਤਰੀਕੇ ਦੇ ਨਾਲ ਉਹ ਉਗਾ ਸਕਦੇ ਹਨ ਅਤੇ ਨਵੇਂ ਅੱਜ ਕੱਲ੍ਹ ਦੇ ਕਿਸਾਨ ਹਨ ਅੱਜ ਕੱਲ੍ਹ ਦਾ ਕਿਸਾਨ ਵਧੀਆ ਟਰੈਕਟਰ ਵਧੀਆ ਟਰਾਲੀ ਅਤੇ ਵਧੀਆ ਖੇਤੀ ਦਾ ਸੰਦਾਂ ਹੈ ਜੋ ਉਹ ਰੱਖਣਾ ਪਸੰਦ ਕਰਦਾ ਹੈ ਜਿਸ ਵਿੱਚ ਉਸਨੂੰ ਖੇਤੀ ਨੂੰ ਕਰਨ ਵਿੱਚ ਉਸਨੂੰ ਮਦਦ ਮਿਲਦੀ ਹੈ ਇਸ ਦੇ ਨਾਲ ਖੇਤੀ ਹੈ ਜੋ ਬੜੀ ਵਧੀਆ ਤਰੀਕੇ ਦੇ ਨਾਲ ਦੁੱਗਣੀ ਚੌਗਣੀ ਵਧੀਆ ਹੁੰਦੀ ਹੈ ਇਹ ਤੋਂ ਇਲਾਵਾ ਪਿੱਗ ਫਾਰਮਿੰਗ ਬੱਕਰੀਆਂ ਦਾ ਫਾਰਮ ਨਵੇਂ ਯੁੱਗ ਦੇ ਕਿਸਾਨ ਕਰਨ ਦੇ ਵਿੱਚ ਕੋਈ ਹਿਚਕਚਾਹਟ ਨਹੀਂ ਮੰਨਦੇ ਅਤੇ ਇਹ ਵਧੀਆ ਤਰੀਕੇ ਨਾਲ ਕਰਨ ਵਾਲੇ ਕੰਮ ਹਨ ਇਸ ਤੋਂ ਇਲਾਵਾ ਨਵੇਂ ਯੁੱਗ ਦੇ ਕਿਸਾਨ ਬਾਹਰੋਂ ਬਾਹਰਲੇ ਦੇਸ਼ਾਂ ਤੋਂ ਜਿੱਦਾਂ ਅਮੈਰੀਕਾ ਕਨੇਡਾ ਅਤੇ ਹੋਰ ਬਾਹਰਲੇ ਦੇਸ਼ਾਂ ਤੋਂ ਵਧੀਆ ਟਰੈਕਟਰ ਲਿਆਉਣ ਦੇ ਵੀ ਸ਼ੌਕੀਨ ਹਨ ਅਤੇ ਰੋਟਾਵੀਟਰ ਵਗੈਰਾ ਅਤੇ ਵਧੀਆ ਕਣਕ ਬੀਜਣ ਵਾਲੀਆਂ ਮਸ਼ੀਨਾਂ ਦੇ ਵੀ ਸ਼ੌਂਕੀਨ ਹਨ ਨਵੇਂ ਯੁੱਗ ਦੇ ਕਿਸਾਨ ਕਿਸਾਨਾਂ ਦਾ ਇਹ ਕਰਨਾ ਪਸੰਦ ਕਰਦੇ ਹਨ